ਸਾਡੇ ਖੇਤਰ ਵਿੱਚ ਆਮ ਤੌਰ 'ਤੇ ਕਲਾ ਡਿਜ਼ੀਟਲ ਮਾਰਕੀਟਿੰਗ ਅਤੇ ਸਧਾਰਨ ਉਤਪਾਦ ਨਾਲ ਜੁੜੇ ਕਾਰੋਬਾਰ ਵਧੀਆ ਵਿਕਾਸ ਕਰ ਸਕਦੇ ਹਨ ਕਲਾ ਆਈਟਮ ਪੇਂਟਿੰਗ ਅਤੇ ਡਿਜ਼ੀਟਲ ਕਲਾ ਪ੍ਰੇਮੀ ਲੋਕ ਆਪਣੇ ਘਰ ਦਫ਼ਤਰ ਅਤੇ ਏਵਨ ਟੈਂਸ ਲਈ ਯੂਨੀਕ ਚਿੱਤਰਾਂ ਜਾਂ ਪੋਸਟਰ ਮੰਗਦੇ ਹਨ ਜੇਕਰ ਤੁਸੀਂ ਚਿੱਤਰਕਾਰੀ ਜਾਂ ਡਿਜ਼ਾਇਨ 'ਚ ਦਾਖਲ ਹੋ ਤਾਂ ਆਨਲਾਈਨ ਆਫਲਾਈਨ ਕਲਾਸਸ ਸ਼ੁਰੂ ਕਰ ਸਕਦੇ ਹੋ ਜੇਕਰ ਤੁਸੀਂ ਡਿਜ਼ੀਟਲ ਓਡਰ ਕਰਦੇ ਹਾਂ ਤਾਂ ਐਨ ਐਫ ਟੀ ਨੋਨ ਫਲੈਕਸੀਬਲ ਟੋਕਨ 'ਚ ਵਿਕਰੀ ਦੀ ਸੰਭਾਵਨਾ ਬਹੁਤ ਜ਼ਿਆਦਾ ਹੈ ਛੋਟੀ ਕੰਪਨੀਆਂ ਨੂੰ ਲੋਗੋ ਬੈਨਰ ਅਤੇ ਸ਼ੋਸ਼ਲ ਮੀਡੀਆ ਡਿਜ਼ੀਟਾਈਸ ਦੀ ਲੋੜ ਹੈ ਜੇਕਰ ਮੈਂ ਕਾਰੋਬਾਰ ਸ਼ੁਰੂ ਕਰਦਾ ਹਾਂ ਤਾਂ ਕੀ ਕਰਦਾ ਮੈਂ ਕਸਟਮਰ ਪੇਂਟਿੰਗ ਅਤੇ ਡਿਜ਼ੀਟਲ ਮਾਰਕੀਟ ਸੇਵਾਵਾਂ ਉੱਤੇ ਧਿਆਨ ਦਿੰਦਾ ਹਰ ਵਿਅਕਤੀ ਆਪਣੇ ਘਰ ਜਾਂ ਦਫ਼ਤਰ ਲਈ ਕੁਛ ਵਿਲੱਖਣ ਚਾਹੁੰਦਾ ਹੈ ਸ਼ੋਸ਼ਲ ਮੀਡੀਆ 'ਤੇ ਆਸਾਨ ਤਰੀਕੇ ਨਾਲ ਵੇਚ ਸਕਦਾ ਹਾਂ ਇੰਸਟਾਗ੍ਰਾਮ ਫੇਸਬੁੱਕ ਵਰਗੀਆਂ ਸਾਈਟਾਂ ਉਤੇ ਆਪਣੇ ਕੰਮ ਨੂੰ ਵੇਚਣ ਲਈ ਵਿਗਿਆਪਨ ਮੌਕਾ ਹਨ ਇੱਕ ਕਾਰੋਬਾਰ ਘੱਟ ਲਾਗਤ ਨਾਲ ਸ਼ੁਰੂ ਕੀਤੀ ਜਾ ਸਕਦਾ ਹੈ ਪਰ ਕਲਾ ਦੀ ਵਿਲੱਖਣਤਾ 'ਤੇ ਉੱਚੀ ਕੀਮਤ ਲਗਾਈ ਜਾ ਸਕਦੀ ਹੈ